ਮੇਰਾ ਨਾਮ ਸਮਰੀਤੀ ਮੈਂ ਪਿੱਛਲੇ ਹਫ਼ਤੇ ਇਕੱਤੀ ਅਕਤੂਬਰ ਦੋ ਹਜ਼ਾਰ ਤੇਈ ਨੂੰ ਆਪਣੇ ਵਾਸਤੇ ਐਮਾਜੌਨ ਤੋਂ ਔਡਰ ਕੀਤਾ ਸੀ ਮੈਂ ਆਪਣੇ ਵਾਸਤੇ ਫ਼ੋਨ ਮੰਗਵਾਇਆ ਸੀ ਜਿਸ ਦੀ ਪੇਅਮੈਂਟ ਦਸ ਹਜ਼ਾਰ ਤੋਂ ਉੱਪਰ ਹੈ ਔਡਰ ਕਰਨ ਦੇ ਸਮੇਂ ਹੀ ਮੈਂ ਔਨਲਾਈਨ ਪੇਅਮੈਂਟ ਕਰ ਦਿੱਤੀ ਸੀ ਅਤੇ ਔਨਲਾਈਨ ਔਨਲਾਈਨ ਪੇਅਮੈਂਟ ਕਰਦੇ ਸਮੇਂ ਹੀ ਮੇਰੇ ਖਾਤੇ ਵਿੱਚੋਂ ਮੇਰੇ ਪੈਸੇ ਕਟ ਚੁੱਕੇ ਸਨ ਜਿੰਨੇ ਵੀ ਸਨ ਉਹ ਦਸ ਹਜ਼ਾਰ ਤੋਂ ਉੱਪਰ ਪੇਅਮੈਂਟ ਹੈ ਅਤੇ ਉਸ ਤੋਂ ਬਾਅਦ ਵਿੱਚ ਮੈਨੂੰ ਕਿਸੇ ਕਾਰਨ ਐਮਾਜੌਨ ਤੋਂ ਔਡਰ ਕੈਂਸਲ ਕਰਨਾ ਪਿਆ ਕਿਉਂਕਿ ਮੈਨੂੰ ਪੈਸੇ ਮੇਰੇ ਕਿਸੇ ਹੋਰ ਨਿੱਜੀ ਕਾਰਨ ਵਾਸਤੇ ਚਾਹੀਦੇ ਸਨ ਔਡਰ ਕੈਂਸਲ ਕਰਨ ਕਰੇ ਹੋਏ ਵੀ ਮੈਨੂੰ ਕਾਫ਼ੀ ਦਿਨ ਹੋ ਚੁੱਕੇ ਹਨ ਉਹ ਪੇਅਮੈਂਟ ਹਲੇ ਤੱਕ ਮੇਰੇ ਖਾਤੇ ਵਿੱਚ ਵਾਪਸ ਨਹੀਂ ਆਈ ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਗੀ ਕਿ ਜਿੰਨਾ ਜਲਦੀ ਹੋ ਸਕੇ ਤੁਸੀਂ ਉਹ ਪੇਅਮੈਂਟ ਮੈਨੂੰ ਮੇਰੇ ਖਾਤੇ ਵਿੱਚ ਦੇ ਦਿਉ ਸੋ ਦੈਟ ਜਿਸ ਕਰਕੇ ਮੈਂ ਆਪਣਾ ਔਡਰ ਵੀ ਕੈਸਲ ਕੀਤਾ ਅਤੇ ਜਿਸ ਕੰਮ ਵਾਸਤੇ ਮੈਨੂੰ ਪੈਸੇ ਚਾਹੀਦੇ ਸਨ ਮੈਂ ਉਸ ਕੰਮ ਵਾਸਤੇ ਉਹ ਉਸ ਕੰਮ ਵਾਸਤੇ ਉਹ ਪੈਸੇ ਯੂਜ਼ ਕਰ ਸਕਾਂ ਅਤੇ ਮੇਰਾ ਕਾਫ਼ੀ ਸ ਸਮੇਂ ਤੋਂ ਤੁਹਾਡੇ ਬੈਂਕ ਵਿੱਚ ਖਾਤਾ ਹੈ ਅਤੇ ਮੇਰੇ ਘਰਦਿਆਂ ਦੇ ਖਾਤਾ ਵੀ ਤੁਹਾਡੇ ਬੈਂਕ ਦੇ ਵਿੱਚ ਹੀ ਹੈ ਇਸ ਤੋਂ ਪਹਿਲਾਂ ਨਾ ਮੈਨੂੰ ਨਾ ਹੀ ਮੇਰੇ ਕਿਸੇ ਘਰਦੇ ਨੂੰ ਇਹੋ ਜਿਹੀ ਕੋਈ ਦਿੱਕਤ ਨਹੀਂ ਆਈ ਪਰ ਇਸ ਵਾਰ ਪਤਾ ਨਹੀਂ ਕਿਸ ਕਾਰਨ ਕਰਕੇ ਇਹ ਦਿੱਕਤ ਆ ਰਹੀ ਹੈ ਮੈਂ ਤੁਹਾਨੂੰ ਕਹਿਣਾ ਚਾਹੁੰਗੀ ਕਿ ਜਿੰਨੀ ਜਲਦੀ ਹੋ ਸਕੇ ਤੁਸੀਂ ਇਸ ਇਸ਼ੂ ਨੂੰ ਰੀਸੌਲਵ ਕਰੋ ਅਤੇ ਮੈਨੂੰ ਮੇਰੇ ਖਾਤੇ ਵਿੱਚ ਵਾਪਸ ਪੈਸੇ ਪਾ ਦਿਉ ਅਤੇ ਮੈਂ ਤੁਹਾਨੂੰ ਕਹਿਣਾ ਚਾਹੁੰਗੀ ਕਿ ਅੱਗੇ ਤੋਂ ਇਹੋ ਜਿਹੀ ਕੋਈ ਵੀ ਮਤਲਬ ਗ਼ਲਤੀ ਨਾ ਕਰਿਉ ਅਤੇ ਜਿਸ ਕਰਕੇ ਤੁਹਾਡੇ ਜੋ ਕਨਜਿਊਮਰਸ ਹੈ ਉਹਨਾਂ ਨੂੰ ਇੰਨਕਨਵੀਨੀਐਂਸ ਹੋਵੇ ਅਤੇ ਅਤੇ ਮੈਨੂੰ ਮੇਰੇ ਪੈਸੇ ਜਲ ਜਿੰਨੀ ਜਲਦੀ ਹੋ ਸਕੇ ਵਾਪਸ ਕਰ ਦਿਉ ਸੋ ਦੈਟ ਕਿ ਮੈਂ ਜਿਸ ਕੰਮ ਵਾਸਤੇ ਆਪਣੇ ਪੈਸੇ ਵਰਤਣੇ ਉਹ ਕੰਮ ਮੈਂ ਕਰ ਸਕਾਂ ਅਤੇ ਮੈਨੂੰ ਕੋਈ ਵੀ ਉਸ ਕਰਕੇ ਕੋਈ ਵੀ ਦਿੱਕਤ ਜਾਂ ਮੁਸ਼ਕਲ ਨਾ ਹੋਵੇ